ਭਾਰਤ ਵਿੱਚ ਕੁਝ ਮਸ਼ਹੂਰ ਨਾਚ ਸ਼ੈਲੀ ਦੇ ਰੂਪ ਅਜਿਹੇ ਹਨ ਵੈਸੇ ਤਾਂ ਹਰ ਸਮਾਜ ਹਰ ਰਾਜ ਦੇ ਆਪਣੇ ਆਪਣੇ ਹੀ ਨਾਚ ਨੇ ਜਦ ਕਿ ਕੱਥਕ ਦਾ ਨਾਮ ਲਈਏ ਤਾਂ ਬ੍ਰਿਜ ਮਹਾਰਾਜ ਜੀ ਦਾ ਨਾਂ ਸਭ ਤੋਂ ਪਹਿਲਾਂ ਦਿਮਾਗ ਵਿੱਚ ਆਉਂਦਾ ਹੈ ਇਹਨਾਂ ਦੀ ਕਲਾ ਅਦਭੁੱਤ ਹੈ ਅਤੇ ਕਲਾ ਵਿੱਚ ਵੀ ਬਹੁਤ ਹੀ ਨਿਪੁੰਨ ਹਨ ਇਹਨਾਂ ਦਾ ਪੂਰਾ ਨਾਮ ਬ੍ਰਿਜ ਮੋਹਣ ਮਿਸ਼ਰ ਸੀ ਉਹਨਾਂ ਦਾ ਪਰਿਵਾਰ ਕੱਥਕ ਡਾਂਸਰ ਸੀ ਉਹ ਸੰਸਾਰ ਵਿੱਚ ਪ੍ਰਸਿੱਧ ਕੱਥਕ ਦੇ ਰੂਪ ਤੋਂ ਜਾਣਿਆ ਜਾਂਦਾ ਸੀ ਜਿਵੇਂ ਕਿ ਭਾਰਤ ਨਾਟਕ ਕੱਥਕ ਉੜੀਸਾ ਮਨੀਪੁਰਾ ਕੁਚੀਪੁਰਾ ਭੰਗੜਾ ਗਿੱਧਾ ਇਹ ਤਾਂ ਸਾਡੇ ਭਾਰਤ ਪੰਜਾਬ ਦਾ ਪ੍ਰਸਿੱਧ ਪ੍ਰਸਿੱਧ ਨਾਚ ਚ ਡ ਡਾਂਸ ਸ਼ੈਲੀ ਰੂਪ ਹੈ ਕਥਾਵਾਚਕ ਜੋ ਕਿ ਕੇਰਾ ਵਿੱਚ ਵੀ ਹੈ